ਛੱਬੀ ਨਵੰਬਰ ਉੱਨੀ ਸੌ ਪਚਾਨਵੇਂ ਅੱਠ ਸਤੰਬਰ ਉੱਨੀ ਸੌ ਸਤਾਨਵੇਂ ਦੋ ਫਰਵਰੀ ਦੋ ਹਜ਼ਾਰ ਅੱਠ ਤੇਰਾਂ ਨਵੰਬਰ ਉੱਨੀ ਸੌ ਨੜਿਨਵੇਂ ਚੌਵੀ ਸਤੰਬਰ ਦੋ ਹਜ਼ਾਰ ਬਾਈ